ਜੀ ਹਾਂ ਮੈਂ ਆਪਣਾ ਰਿਕਾਰਡ ਡਾਟਾ ਬੇਸ ਕੰਪਿਊਟਰ ਵਿੱਚ ਰੱਖਦੀ ਹਾਂ ਕਿਉਂਕਿ ਇਸ ਨਾਲ ਮੇਰਾ ਰਿਕਾਰਡ ਕੀਤਾ ਗਿਆ ਰਿਕਾਰਡ ਕੀਤੀ ਗਈ ਇਨਫੋਰਮੇਸ਼ਨ ਕਿਤੇ ਵੀ ਨਹੀਂ ਜਾਂਦੀ ਉਹ ਉੱਥੇ ਹੀ ਰਹਿੰਦੀ ਹੈ ਮੇਰੇ ਬਾਕੀ ਜਦੋਂ ਵੀ ਮੈਨੂੰ ਕਿਸ ਉਸਦੀ ਜ਼ਰੂਰਤ ਹੈ ਤਾਂ ਮੈਂ ਕੱਢ ਸਕਦੀ ਹਾਂ